ਹੈਲੋ ਹਾਂ ਜਦੋਂ ਮੈਂ ਵਿਦੇਸ਼ ਤੋਂ ਵਾਪਿਸ ਆ ਰਿਹਾ ਸੀ ਤਾਂ ਮੇਰਾ ਪਾਸਪੋਰਟ ਚੋਰੀ ਹੋ ਗਿਆ ਅਤੇ ਇਹ ਦੁਰਘਟਨਾ ਮੇਰੇ ਨਾਲ ਦਿੱਲੀ ਏਅਰਪੋਰਟ ਵਿ ਵਿਖੇ ਹੋਈ ਹੈ ਅਤੇ ਉਸ ਤੋਂ ਬਾਅਦ ਮੈਂ ਸਿੱਧਾ ਏਅਰਪੋਰਟ ਦੇ ਸਿਕ ਏਅਰਪੋਰਟ 'ਤੇ ਸਥਿਤ ਪੁਲਿਸ ਕੋਲ ਗਿਆ ਅਤੇ ਉਹਨਾਂ ਨੂੰ ਆਪਣੀ ਇਸ ਪਾਸਪੋਰਟ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਇਸ ਲਈ ਮੇਰਾ ਪਾਸਪੋਰਟ ਦੀ ਅਨਾਉਂਸਮੈਂਟ ਵੀ ਕੀਤੀ ਅਤੇ ਉਹਨਾਂ ਨੇ ਉਸ ਲਈ ਜ਼ਰੂਰੀ ਜਾਂਚ ਪੜਤਾਲ ਸ਼ੁਰੂ ਕੀਤੀ ਅਤੇ ਮੇਰਾ ਪਾਸਪੋਰਟ ਲਭ ਲੱਭ ਕੇ ਦਿੱਤਾ ਅਤੇ ਇਹਦੇ ਲਈ ਜਿਹਨੂੰ ਬੜਾਵਾ ਦੇਣਾ ਹੈਗਾ ਕਿ ਸਾਡੇ ਇਹ ਸੁਵਿਧਾਵਾਂ ਵਧੀਆ ਰਹਿਣ ਅਤੇ ਇਸ ਲਈ ਨਵੀਂ ਟੈਕਨੀਕ ਯੂਜ ਕੀਤੀ ਜਾਵੇ ਜਿਵੇਂ ਕਿ ਪਾਸਪੋਰਟਾਂ ਵਿੱਚ ਇੱਕ ਚਿੱਪ ਲੱਗ ਸਕਦੀ ਹੈ ਜੋ ਤੁਹਾਡੇ ਪਾਸਪੋਰਟ ਨੂੰ ਟਰੈਕ ਕਰੇ ਕਿ ਤੁਸੀਂ ਕਿੱਥੇ ਹੋ ਧੰਨਵਾਦ